ਹੈਲੋ ਹਾਂਜੀ ਅੱਛਾ ਜੀ ਆ ਜਾਓ ਸਿਖਾ ਦਵਾਂਗੇ ਸਿਖਾ ਦਵਾਂਗੇ ਹਜ਼ਾਰ ਰੁਪਇਆ ਹਾਂਜੀ ਇਹ ਡਬਲ ਫੀਸ ਹੋ ਜਾਏਗੀ ਹਾਂਜੀ ਸਾਰਿਆਂ ਨੇ ਜੀ ਸਵੇਰੇ ਦਸ ਤੋਂ ਬਾਰਾਂ ਸ਼ਾਮ ਚਾਰ ਤੋਂ ਛੇ ਚਾਰ ਤੋਂ ਛੇ ਐਨੀ ਲੱਗੇਗੀ ਜਿੰਨੇ ਅੱਗੇ ਹਜ਼ਾਰ ਰੁਪਿਆ ਹੀ ਹੈ ਸਤਾ ਜਿਹੜੀ ਚੀਜ਼ ਸਿੱਖੋਗੇ ਫੀਸ ਅਸੀਂ ਇੱਕੋ ਹੀ ਰੇਟ ਰੱਖਿਆ ਸਾਰੀਆਂ ਚੀਜ਼ਾਂ ਦਾ ਬਸ ਬਸ ਢੋਲ ਹੈਗਾ ਹਾਂਜੀ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਸਿਖਾ ਦਵਾਂਗੇ ਤੁਸੀਂ ਇੱਕ ਵਾਰ ਆਓ ਤਾਂ ਸਹੀ ਸੈਂਟਰ ਦੇ ਵਿੱਚ ਭਾਵੇਂ ਸਵੇਰੇ ਆ ਜਾਓ ਐਡਰੈਸ ਬਸਤੀ ਹਜੂਰ ਸਿੰਘ ਗਲੀ ਨੰ ਗਲੀ ਨੰਬਰ ਇੱਕ ਤਖਤ ਦੇ ਵਿੱਚ ਹੀ ਹੈਗਾ ਮੰਦਿਰ ਹੈਗਾ ਕਚਹਿਰੀ ਦੇ ਨਾਲ ਬਸ ਉੱਥੇ ਰਹਿੰਦੇ ਦਸ ਕੁ ਤੱਕ ਤਾਂ ਪਹੁੰਚ ਹੀ ਜਾਓਗੇ ਬਸ ਓਕੇ